ਭੰਗੜਾ ਲੋਕ ਨਾਚ ਮਨੋਰੰਜਨ ਦੇ ਨਾਲ ਨਾਲ ਸਿਹਤ ਵਾਸਤੇ ਵੀ ਬਹੁਤ ਹੀ ਕਾਰਗਰ ਸਿੱਧ ਹੈ ਕਿਉਂਕਿ ਇਸ ਵਿੱਚ ਪੂਰੀ ਜ਼ੋਰ ਨਾਲ ਭੰਗੜਾ ਪੈਂਦਾ ਹੈ ਭੰਗੜਾ ਦੇ ਵਿੱਚ ਭੱਜਣਾ ਪੈਂਦਾ ਹੈ ਬੈਠ ਕੇ ਵੀ ਭੰਗੜਾ ਪੈਂਦਾ ਹੈ ਛਾਲ ਮਾਰਨੀ ਪੈਂਦੀ ਹੈ ਇੱਕ ਦੂਜੇ ਦੇ ਮੋਢਿਆਂ 'ਤੇ ਬੈਠ ਕੇ ਵੀ ਆਪਾਂ ਭੰਗੜਾ ਪਾਉਂਦੇ ਹਾਂ ਭੰਗੜਾ ਇੱਕ ਸਿਹਤ ਨੂੰ ਬਹੁਤ ਹੀ ਤੰਦਰੁਸਤ ਰੱਖਦਾ ਹੈ ਭੰਗੜਾ ਰੋਂਦੇ ਚਿਹਰੇ ਨੂੰ ਵੀ ਹੱਸਣ ਲੱਗ ਜਾਂਦਾ ਹੈ ਭੰਗੜਾ ਇੰਨੀ ਵਧੀਆ ਪ੍ਰੈਕਟਿਸ ਹੁੰਦੀ ਆ ਭੰਗੜੇ ਦੀ ਕਿਉਂਕਿ ਇਹਦੇ ਵਿੱਚ ਘੱਟੋ ਘੱਟ ਅੱਧਾ ਪੌਣਾ ਘੰਟਾ ਲੱਗਦਾ ਹੈ ਜਦੋਂ ਵੀ ਆਪਾਂ ਭੰਗੜਾ ਸਟਾਰਟ ਕਰਦੇ ਹਾਂ ਅੱਧੇ ਪੌਣੇ ਘੰਟੇ ਦੀ ਪ੍ਰੈਕਟਿਸ ਸਰੀਰ ਨੂੰ ਬਹੁਤ ਹੀ ਫਿੱਟ ਕਰ ਦਿੰਦੀ ਹੈ ਜੋ ਕਿ ਬੰ ਤੰਦਰੁਸਤੀ ਆਉਂਦੀ ਹੈ ਵਧੀਆ ਭੁੱਖ ਲੱਗਦੀ ਹੈ ਬੰਦੇ ਨੂੰ ਪ੍ਰੈਕਟਿਸ ਕਰਕੇ ਅਤੇ ਆਪਾਂ ਨੂੰ ਕੋਈ ਜਿਮ ਵਗੈਰਾ ਜਾਣ ਦੀ ਵੀ ਲੋੜ ਨਹੀਂ ਜੇ ਬੰਦਾ ਭੰਗੜੇ ਦੀ ਪ੍ਰੈਕਟਿਸ ਕਰਦਾ ਹੈ ਭੰਗੜਾ ਇੱਕ ਐਸੀ ਚੀਜ਼ ਹੈ ਜੋ ਕਿ ਪਹਿਲਾਂ ਤੋਂ ਸਾਡੇ ਪੰਜਾਬੀਆਂ ਨੇ ਇਸ ਨੂੰ ਨਾਚ ਦੇ ਨਾਲ ਨਾਲ ਸਿਹਤ ਵਾਸਤੇ ਵੀ ਵਰਤਿਆ ਹੈ ਇਹਦੇ ਨਾਲ ਬਹੁਤ ਵਧੀਆ ਪ੍ਰੈਕਟਿਸ ਹੁੰਦੀ ਹੈ ਸਹੀ ਇਹਦੇ ਵਿੱਚ ਤੀਹ ਮਿੰਟ ਤੋਂ ਲੈ ਕੇ ਪੰਤਾਲੀ ਮਿੰਟ ਤੱਕ ਦਾ ਪ੍ਰੈਕਟਿਸ ਹੁੰਦੀ ਹੈ ਜੋ ਵੀ ਭੰਗੜੇ ਦੀ ਪ੍ਰੈਕਟਿਸ ਕਰਦੇ ਹਾਂ ਆਪਾਂ ਇਹਦੇ ਨਾਲ ਸਿਹਤ ਵਧੀਆ ਰਹਿੰਦੀ ਹੈ ਭੁੱਖ ਲੱਗਦੀ ਹੈ ਭੰਗੜਾ ਇੱਕ ਐਸੀ ਚੀਜ਼ ਹੈ ਜੋ ਕਿ ਬੰਦੇ ਦੇ ਚਿਹਰੇ 'ਤੇ ਕੋਈ ਵੀ ਗਮ ਹੈ ਉਸ ਨੂੰ ਹੱਸਣ ਲਾ ਦਿੰਦਾ ਹੈ ਭੰਗੜਾ ਨਾਲ ਸਿਹਤ ਸਰੀਰ ਫਿਟ ਰਹਿਣਾ ਤੰਦਰੁਸਤੀ ਬਣਨੀ ਆਪਣੇ ਕੋਈ ਗੋਡਾ ਲੱਤ ਦੁਖਦੀ ਹੈ ਸਭ ਕੁਛ ਇਸ ਨਾਲ ਵਧੀਆ ਹੋ ਜਾਂਦਾ ਹੈ ਭੰਗੜੇ ਨੂੰ ਲੋਕ ਵਿੱਚ ਪ੍ਰੈਕਟਿਸ ਦੇ ਤੌਰ 'ਤੇ ਵੀ ਭੰਗੜਾ ਪਾਉਂਦੇ ਨੇ ਵੀ ਨਾਲ ਸਾਡੀ ਪ੍ਰੈਕਟਿਸ ਹੋ ਜੂ ਨਾਲ ਸਾਡਾ ਇੰਜੋਏ ਦਾ ਇੰਜੋਏ ਹੋ ਜਾਂਦਾ ਹੈ ਭੰਗੜਾ ਇੱਕ ਐਸੀ ਚੀਜ਼ ਹੈ ਵੀ ਜਿਸ ਨੂੰ ਲੋਕ ਬਹੁਤ ਹੀ ਚਾਹੁੰਦੇ ਨੇ ਭੰਗੜੇ ਨਾਲ ਜੇ ਆਪਾਂ ਸ ਡੇਲੀ ਭੰਗੜਾ ਪਾਉਂਦੇ ਹਾਂ ਤਾਂ ਆਪਾਂ ਨੂੰ ਬਹੁਤ ਹੀ ਬੈਨੀਫਿਟ ਮਿਲਦਾ ਹੈ ਭੰਗੜੇ ਦਾ ਕਿਉਂਕਿ ਇਹਦੇ ਨਾਲ ਆਪਾਂ ਨੂੰ ਕੋਈ ਹੋਰ ਨਾ ਕੋਈ ਦਵਾਈ ਲੈਣੀ ਨਾ ਕੁਛ ਹੋਰ ਕਰਨਾ ਠੀਕ ਹੈ ਭੰਗੜਾ ਇੱਕ ਆਯੁਰਵੈਦਿਕ ਆਪਣਾ ਉਹ ਮੰਨ ਲਓ ਵੀ ਕੀ ਕੇ ਪੰਜਾਬੀ 'ਚ ਵੀ ਇਹਨੂੰ ਬਹੁਤ ਹੀ ਵਧੀਆ ਕਾਰਗਰ ਸਿੱਧ ਹੈ ਮੰਨ ਲਓ ਜਿਵੇਂ ਕੋਈ ਯੋਗਾ ਕਰਦਾ ਹੈ ਇਹ ਭੰਗੜਾ ਉਸ ਤੋਂ ਵੀ ਵਧੀਆ ਹੈ ਵੀ ਯੋਗੇ ਨਾਲੋਂ ਵੀ ਵਧੀਆ ਬੈਟਰ ਰਹਿੰਦਾ ਭੰਗੜੇ ਨਾਲ ਬੰਦਾ ਭੰਗੜਾ ਇੱਕ ਬਹੁਤ ਹੀ ਵਧੀਆ ਚੀਜ਼ ਹੈ ਜੋ ਕਿ ਤੰਦਰੁਸਤੀ ਵਾਸਤੇ ਬੰਦੇ ਦੀ ਤੰਦਰੁਸਤੀ ਵਾਸਤੇ ਬਹੁਤ ਚੰਗੀ ਚੀਜ਼ ਹੈ ਧੰਨਵਾਦ